ਮੈਂ ਅਗਰ ਆਪਣੇ ਇਲਾਕੇ ਦੀ ਗੱਲ ਕਰਾਂ ਆਪਣੇ ਖੇਤਰ ਦੀ ਗੱਲ ਕਰਾਂ ਤਾਂ ਇੱਥੇ ਮਿਠਾਈ ਹੈ ਸਾਡੇ ਇੱਕ ਬਹੁਤ ਵਧੀਆ ਤੋਸ਼ਾ ਤੋਸ਼ਾ ਨਾਮ ਦੀ ਮਿਠਾਈ ਬਹੁਤ ਵਧੀਆ ਪ੍ਰਚਲਿਤ ਹੈ ਔਰ ਕੋਈ ਵੀ ਉਹ ਅਗਰ ਉਸ ਵਪਾਰ ਦੇ ਵਿੱਚ ਆਪਣਾ ਇਨਵੈਸਟ ਕਰਦਾ ਤਾਂ ਇਹ ਬਿਨਾਂ ਸੋਚੇ ਕਹਿ ਸਕਦੇ ਹਾਂ ਕਿ ਆਪਾਂ ਉਹ ਕੰਮ ਬਹੁਤ ਜ਼ਿਆਦਾ ਚੱਲੇਗਾ ਕਿਉਂਕਿ ਇੱਧਰ ਦੀ ਜੋ ਮਿਠਾਈ ਹੈ ਉਹ ਦੂਰ ਦੂਰ ਤੱਕ ਜਾਂਦੀ ਹੈ ਔਰ ਲੋਕ ਸਪੈਸ਼ਲ ਇਸ ਚੀਜ਼ ਨੂੰ ਲੈਣ ਵਾਸਤੇ ਇੱਧਰ ਆਉਂਦੇ ਨੇ ਔਰ ਦੂਸਰਾ ਦੇਖਿਆ ਜਾਵੇ ਤਾਂ ਇੱਥੋਂ ਤੁਸੀਂ ਜੁੱਤੀ ਬਹੁਤ ਮਸ਼ਹੂਰ ਹੈ ਔਰ ਇਹ ਪੰਜਾਬ ਭਾਰਤ ਤੋਂ ਬਾਹਰ ਦੇ ਇਲਾਕਿਆਂ ਦੇ ਵਿੱਚ ਵੀ ਇੱਥੋਂ ਦੀ ਜੁੱਤੀ ਕਾਫੀ ਪ੍ਰਚਲਿਤ ਹੈ ਔਰ ਨਾਲ ਹੀ ਅਗਰ ਕੋਈ ਹੋਰ ਦੇਖਿਆ ਜਾਵੇ ਤਾਂ ਇੱਧਰ ਰੇਤੇ ਦਾ ਵਪਾਰ ਬਹੁਤ ਵਧੀਆ ਚੱਲਦਾ ਰੇਤੇ ਦਾ ਕੰਮ ਅਗਰ ਕੋਈ ਕਰੇ ਤਾਂ ਮੈਂ ਨਹੀਂ ਸਮਝਦਾ ਕਿ ਉਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਏਗੀ ਔਰ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਲੋਸ ਹੋਏਗਾ